ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤਾਨੀਆ ਬੋਲ ਰਹੀ ਹਾਂ ਦੱਸੋ ਹਾਂਜੀ ਹਾਂਜੀ ਮੈਂ ਹਾਂਜੀ ਬੀਜ ਬਾਰੇ ਰਿਸਰਚ ਕੀਤੀ ਹੈ ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਹਾੜੀ ਸੋਣੀ ਦੀਆਂ ਫਸਲਾਂ ਵਾ ਪਹਿਲਾਂ ਅਸੀਂ ਬੀਜਦੇ ਸੀ ਜੇ ਸਾਨੂੰ ਥੋੜ੍ਹੀ ਕਮਾਈ ਹੁੰਦੀ ਸੀ ਇੱਕ ਕਿੱਲੇ ਵਿੱਚ ਪਰ ਅਸੀਂ ਹੁਣ ਬੀਜਦੇ ਹਾਂ ਹਰ ਉਹਨਾਂ ਦੀ ਪੈਦਾਵਾਰ ਜ਼ਿਆਦਾ ਹੋ ਗਈ ਆ ਹੁਣ ਜਿਵੇਂ ਪਹਿਲਾਂ ਅਸੀਂ ਇੱਕ ਕਿੱਲੇ ਵਿੱਚੋਂ ਇੱਕ ਲੱਖ ਦੀ ਰਕਮ ਰਿਸੀਵ ਕਰਦੇ ਸੀ ਪਰ ਹੁਣ ਅਸੀਂ ਇੱਕ ਲੱਖ ਦੀ ਰਕਮ ਨਾਲੋਂ ਡੇਢ ਲੱਖ ਦੀ ਰਕਮ ਲੈਂਦੇ ਹਾਂ ਸਮਝਦੇ ਹੋ ਮੇਰੀ ਗੱਲ ਹਾਂਜੀ ਇੱਦਾਂ ਕਰਕੇ ਆ ਹਾੜੀ ਸੋਣੀ ਸਾਨੂੰ ਬਹੁਤ ਪ੍ਰੋਫਿਟ ਆ ਹੁਣ ਬਹੁਤ ਜ਼ਿਆਦਾ ਪੈਦਾਵਾਰ ਹੋ ਗਈ ਹੈ ਇਸਦੀ ਅਤੇ ਬਹੁਤ ਜ਼ਿਆਦਾ ਵਧੀਆ ਹਨ ਬਹੁਤ ਪ੍ਰੋਫਿਟ ਹੋ ਰਿਹਾ ਬਹੁਤ ਬੈਨੀਫਿਟ ਹੈ ਨਹੀਂ ਜੀ ਇਹਨਾਂ ਦੇ ਰੇਟ ਵਿੱਚ ਕੋਈ ਫਰਕ ਨਹੀਂ ਏ ਜੋ ਪ੍ਰੋਫਿਟ ਆ ਉਹ ਸਿਰਫ ਮੈਨੂੰ ਆ ਕਿਉਂਕਿ ਮੈਂ ਰਿਸਰਚ ਕਰ ਰਹੀ ਹਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਕਰਾਂ ਅਤੇ ਉਹਨੇ 'ਚ ਜ਼ਿਆਦਾ ਪੈਸੇ ਕਮਾਵਾਂ

ਹਾਂਜੀ ਮੈਂ ਮਿਲ ਸਕਦੀ ਹਾਂ ਹਾਂਜੀ ਹਾਂਜੀ ਤੁਸੀਂ ਮੇਰਾ ਇਹ ਨੰਬਰ ਸੇਵ ਕਰ ਲਿਓ ਤੁਸੀਂ ਜਿਸ ਦਿਨ ਬੋਲੋਗੇ ਅਸੀਂ ਮਿਲ ਲਾਂਗੇ ਤੁਸੀਂ ਲੋਕੇਸ਼ਨ ਭੇਜ ਦਿਓ ਠੀਕ ਏ ਜੀ ਓਕੇ ਬਾਏ ਠੀਕ